ਇੱਕ ਊਰਜਾਵਾਨ ਪੰਜਾਬੀ ਨਾਚ ਭੰਗੜਾ ਪੰਜਾਬੀ ਕਿਸਾਨਾਂ ਨਾਲ ਇਕ ਸਭਿਆਚਾਰਕ ਅਤੇ ਫਿਰਕੂ ਜਸ਼ਨ ਵਜੋਂ ਸ਼ੁਰੂ ਹੋਇਆ ਇਸ ਦੇ ਆਧੁਨਿਕੀ ਸਮੇਂ ਅਤੇ ਵਿਕਾਸ ਨੇ ਭੰਗੜੇ ਨੂੰ ਆਪਣੀਆਂ ਰਵਾਇਤੀ ਪੰਜਾਬੀ ਜੜ੍ਹਾਂ ਨੂੰ ਬਰਕਰਾਰ ਰੱਖਣ ਦੀ ਇਜਾਜ਼ਤ ਦਿੱਤੀ ਹੈ ਜਦੋਂ ਕਿ ਪ੍ਰਸਿੱਧ ਸੰਗੀਤ ਅਤੇ ਤਸ਼ੀਜਿੰਗ ਸਮੂਹ ਅਧਾਰਿਤ ਮੁਕਾਬਲਿਆਂ ਅਤੇ ਇੱਥੇ ਤੱਕ ਕਿ ਕਸਰਤ ਵਿੱਚ ਏਕੀਕਰਨ ਨੂੰ ਸ਼ਾਮਿਲ ਕਰਨ ਲਈ ਇਸ ਦੀ ਪਹੁੰਚ ਨੂੰ ਵਧਾਉਂਦੇ ਹਨ